ਸਤਿ ਸ਼੍ਰੀ ਅਕਾਲ ਮੇਰਾ ਨਾਂ ਰਮਨਪ੍ਰੀਤ ਕੌਰ ਹੈ ਕੀ ਮੈਂ ਦੀਪ ਮੋਟਰਜ਼ ਦੇ ਮੈਨੇਜਰ ਨਾਲ਼ ਗੱਲ ਕਰ ਰਹੀ ਹਾਂ ਅੱਜ ਹੀ ਮੈਂ ਅੰਮ੍ਰਿਤਸਰ ਜਾਣ ਲਈ ਕੈਬ ਬੁੱਕ ਕਰਵਾਈ ਸੀ ਜਿਸਦੇ ਡਰਾਈਵਰ ਦਾ ਨਾਂ ਮਨਜੀਤ ਸਿੰਘ ਹੈ ਜਦੋਂ ਅਸੀਂ ਕੁਝ ਹੀ ਦੂਰੀ 'ਤੇ ਪਹੁੰਚੇ ਤਾਂ ਕੈਬ ਦਾ ਟਾਇਰ ਪੈਂਚਰ ਹੋ ਗਿਆ ਮੈਂ ਡਰਾਈਵਰ ਨੂੰ ਐਕਸਟ੍ਰਾ ਟਾਇਰ ਬਾਰੇ ਪੁੱਛਿਆ ਤਾਂ ਉਸਨੇ ਨਾਂਹ ਕਰ ਦਿੱਤੀ ਜਿੱਦਾਂ ਕਿੱਦਾਂ ਕਰਕੇ ਅਸੀਂ ਟਾਇਰ ਦਾ ਪੈਂਚਰ ਲਗਵਾ ਲਿਆ ਉਸ ਤੋਂ ਬਾਅਦ ਜਦੋਂ ਅਸੀਂ ਕੁਝ ਹੀ ਦੂਰੀ 'ਤੇ ਗਏ ਤਾਂ ਮੈਂ ਦੇਖਿਆ ਕਿ ਡਰਾਈਵਰ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਜਿਸ ਕਾਰਨ ਚਲਾਨ ਵੀ ਹੋ ਸਕਦਾ ਸੀ ਗੱਡੀ ਦੀ ਹਾਲਤ ਬਿਲਕੁਲ ਹੀ ਸੋਹਣੀ ਨਹੀਂ ਸੀ ਅਤੇ ਉਹ ਬਹੁਤ ਹੀ ਧੂਲ ਮਿੱਟੀ ਨਾਲ਼ ਭਰੀ ਹੋਈ ਸੀ ਕਰੋਨਾ ਦੇ ਕਾਰਨ ਮੈਂ ਉਸਨੂੰ ਮਾਸਕ ਲਗਾਉਣ ਲਈ ਬੋਲਿਆ ਪਰ ਉਸਨੇ ਮਨ੍ਹਾ ਕਰ ਦਿੱਤਾ ਮੈਂ ਡਰਾਈਵਰ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਉਸਦਾ ਰਵੱਈਆ ਬਿਲਕੁਲ਼ ਹੀ ਚੰਗਾ ਨਹੀਂ ਹੈ ਮੈਂ ਤੁਹਾਨੂੰ ਇੰਨਾਂ ਹੀ ਕਹਿਣਾ ਚਾਹੁੰਦੀ ਹਾਂ ਕਿ ਡਰਾਈਵਰ ਨੂੰ ਉਸਦੀ ਗਲਤੀ ਬਾਰੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਅੱਗੋਂ ਇੱਦਾਂ ਦਾ ਕੰਮ ਨਹੀਂ ਕੀਤਾ ਜਾਵੇ